ਹੈਲੋ ਸਤਿ ਸ਼੍ਰੀ ਅਕਾਲ ਸਰ ਨਿੱਕੀ ਚਾਟ ਭੰਡਾਰ ਤੋਂ ਬੋਲ ਰਹੇ ਹੋ ਹਾਂਜੀ ਸਰ ਸਰ ਅਸੀਂ ਖਾਣੇ ਦਾ ਆਰਡਰ ਕਰਨਾ ਸੀਗਾ ਹਾਂਜੀ ਸਰ ਹਾਂਜੀ ਸਰ ਇੱਕ ਤਾਂ ਟਿੱਕੀ ਕਰ ਦਿਓ ਪਰ ਜ਼ਿਆਦਾ ਮਸਾਲੇਦਾਰ ਨਾ ਕਰਿਓ ਕਿਉਂਕਿ ਆਰਡਰ ਬੱਚਿਆਂ ਦੇ ਲਈ ਹੈ ਇਸ ਲਈ ਮਸਾਲਾ ਜ਼ਿਆਦਾ ਨਾ ਹੋਵੇ ਹਾਂਜੀ ਸਰ ਬਿਲਕੁਲ ਅਤੇ ਇੱਕ ਸਰ ਗੋਲ ਗੱਪੇ ਕਰ ਦਿਓ ਹਾਂਜੀ ਸਰ ਨਹੀਂ ਸੂਜੀ ਵਾਲੇ ਸਰ ਅਤੇ ਪਾਣੀ ਦੇ ਵਿੱਚ ਜ਼ਿਆਦਾ ਨਮਕ ਨਾ ਕਰਿਓ ਕਿਉਂਕਿ ਪਿਛਲੀ ਵਾਰ ਅਸੀਂ ਤੁਹਾਡੇ ਤੋਂ ਆਰਡਰ ਕੀਤਾ ਸੀ ਤਾਂ ਗੋਲ ਗੱਪਿਆਂ ਦੇ ਪਾਣੀ ਦੇ ਵਿੱਚ ਨਮਕ ਦੀ ਮਾਤਰਾ ਜਿਹੜੀ ਉਹ ਥੋੜ੍ਹੀ ਜ਼ਿਆਦਾ ਸੀਗੀ ਨਹੀਂ ਨਹੀਂ ਸਰ ਬਾਕੀ ਟੇਸਟ ਸਹੀ ਸੀਗਾ ਸਾਰਾ ਕੁਝ ਸਹੀ ਸੀ ਬਸ ਨਮਕ ਦੀ ਮਾਤਰਾ ਥੋੜ੍ਹੀ ਜਿਹੀ ਜ਼ਿਆਦਾ ਸੀਗੀ ਹਾਂਜੀ ਸਰ ਹਾਂਜੀ ਹਾਂਜੀ ਸਰ ਅਤੇ ਪੀਣ ਦੇ ਲਈ ਸਰ ਤੁਸੀਂ ਕੀ ਕੀ ਹੋਣਾ ਆਪਣੇ ਓਕੇ ਸਰ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਸਰ ਐਵੇਂ ਕਰੋ ਫਿਰ ਤੁਸੀਂ ਇੱਕ ਤਾਂ ਓਰੀਓ ਸ਼ੇਕ ਕਰ ਦਿਓ ਹਾਂਜੀ ਸਰ ਓਰੀਓ ਸ਼ੇਕ ਅਤੇ ਇੱਕ ਮਿਕਸ ਜੂਸ ਹੋਣਾ ਸਰ ਆਪਣੇ ਹੈ ਓਕੇ ਸਰ ਇੱਕ ਮਿਕਸ ਜੂਸ ਕਰ ਦਿਓ ਅਤੇ ਸਰ ਇਹਨਾਂ ਦੇ ਵਿੱਚ ਨਾ ਮਿੱਠੇ ਦੀ ਮਾਤਰਾ ਜ਼ਿਆਦਾ ਨਾ ਕਰਿਓ ਨਹੀਂ ਨਹੀਂ ਸਰ ਜ਼ਿਆਦਾ ਨਹੀਂ ਕਰਨੀ ਹੈਗੀ ਹਾਂਜੀ ਸਰ ਸਰ ਸਾਰਾ ਆਰਡਰ ਵਨ ਵੇ ਟਰੈਫਿਕ ਰੋਡ ਗਲੀ ਨੰਬਰ ਸੱਤ ਦੇ ਉੱਪਰ ਪਾਰਸਲ ਕਰਨਾ ਹਾਂਜੀ ਸਰ ਸਰ ਫੋਨ ਨੰਬਰ ਇਹੀ ਹੈ ਜਿਹਤੋਂ ਮੈਂ ਤੁਹਾਨੂੰ ਕਾਲ ਕਰ ਰਹੀ ਹਾਂ ਹਾਂਜੀ ਸਰ ਓਕੇ ਠੀਕ ਹੈ ਜੀ ਧੰਨਵਾਦ